ਜੀ ਮਿਲਾਈਤੀ ਪੰਜਾਬੀ ਭੰਗੜਾ ਸੰਗੀਤ ਵਿੱਚ ਕਈ ਵਾਜੇ ਵਰਤੇ ਜਾਂਦੇ ਹਨ ਜੋ ਇਸ ਦੀ ਉਤਸਾਹ ਭਰੀ ਲੈਅ ਅਤੇ ਊਰਜਾਵਾਨ ਤਾਲ ਨੂੰ ਨਿਰਧਾਰਿਤ ਕਰਦੇ ਹਨ ਇਹ ਸਾਜ਼ ਪੰਜਾਬੀ ਸੰਗੀਤ ਦੀ ਰੂਹ ਹਨ ਅਤੇ ਭੰਗੜੇ ਦੀ ਸ਼ਾਨ ਵਧਾਉਂਦੇ ਹਨ ਪੰਜਾਬੀ ਭੰਗੜਾ ਸੰਗੀਤਕ ਸਾਜ਼ ਅਤੇ ਉਹਨਾਂ ਦੀ ਭੂਮਿਕਾ ਪਹਿਲਾ ਢੋਲ ਢੋਲ ਭੰਗੜੇ ਦਾ ਸਭ ਤੋਂ ਮੁੱਖ ਸਾਜ਼ ਹੈ ਇਹ ਇੱਕ ਵੱਡਾ ਦੋ ਪਾਸਾ ਢੂਮਣ ਵਾਲਾ ਵਾਜਾ ਹੁੰਦਾ ਹੈ ਦੋ ਜੋ ਗੂੰਜਦਾਰ ਅਤੇ ਜੋਸ਼ ਭਰੀ ਯੂਨ ਪੈਦਾ ਕਰਦਾ ਹੈ ਦੂਸਰਾ ਚੰਦਾ ਇੱਕ ਛੋਟਾ ਢੋਲ ਵਰਗਾ ਸਾਜ਼ ਜੋ ਤੇਜ਼ ਤਾਲ ਬਣਾਉਂਦਾ ਹੈ ਤੀਸਰਾ ਢੱਡ ਹੱਥ ਨਾਲ ਵਜਾਈ ਜਾਂਦੀ ਇਕ ਛੋਟੀ ਢੋਲਕ ਚੌਥਾ ਤੂੰਬੀ ਤੂੰਬੀ ਇੱਕ ਤਾਰਾ ਵਾਜਾ ਜੋ ਵਧੇਰੇ ਮਿੱਠੇ ਅਤੇ ਨਿਰਾਲੇ ਸੰਗੀਤਕ ਸੁਰ ਪੈਦਾ ਕਰਦਾ ਹੈ ਅਤੇ ਭੰਗੜੇ ਦੀ ਰਿਧਮ ਵਿੱਚ ਮੌਜੂਦ ਰਹਿੰਦਾ ਹੈ ਪੰਜਵਾਂ ਸਾਪ ਲੱਕੜ ਦਾ ਬਣਿਆ ਇੱਕ ਉੱਚੀ ਆਵਾਜ਼ ਪੈਦਾ ਕਰਨ ਵਾਲਾ ਸਾਜ਼ ਛੇਵਾਂ ਹਰਮੋਨੀਅਮ ਇਹ ਸਾਜ਼ ਪੰਜਾਬੀ ਗਾਇਕੀ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਭੰਗੜੇ ਦੇ ਗੀਤਾਂ ਵਿੱਚ ਮਿੱਠੇ ਸੁਰ ਅਤੇ ਲੈਅ ਜੋੜਨ ਵਾਲੀ ਵਰਤਿਆ ਜਾਂਦਾ ਹੈ ਇਹ ਸਾਰੇ ਸਾਜ਼ ਮਿਲ ਕੇ ਪੰਜਾਬੀ ਭੰਗੜਾ ਸੰਗੀਤ ਦੀ ਰੂਹ ਬਣਾਉਂਦੇ ਹਨ ਜਿਸ ਦੀ ਵਿਖਿਆਤ ਜੋਸ਼ੀਲੀ ਧੁਨ ਪੂਰੀ ਦੁਨੀਆਂ ਵਿੱਚ ਸੁਣੀ ਜਾਂਦੀ ਹੈ